ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਣ ਲਈ ਬਹੁਤ ਸਾਰੇ ਤਰੀਕੇ ਹੁੰਦੇ ਹਨ ਅਤੇ ਇਹਨਾਂ ਤਰੀਕਿਆਂ ਨੂੰ ਕੁਝ ਲੋਕ ਡਿਜੀਟਲ ਮਾਰਕੀਟਿੰਗ ਵੀ ਕਹਿੰਦੇ ਹਨ ਜਾਂ ਕੁਝ ਲੋਕ ਇਸ ਨੂੰ ਪ੍ਰਮੋਸ਼ਨ ਵੀ ਆਖਦੇ ਹਨ ਇਹ ਤਰੀਕੇ ਜ਼ਿਆਦਾਤਰ ਵਪਾਰਕ ਲੋਕ ਹੀ ਵਰਤਦੇ ਹਨ ਤਾਂ ਕਿ ਉਹ ਆਪਣੇ ਵਪਾਰ ਨੂੰ ਹੋਰ ਲੋਕਾਂ ਤੱਕ ਪਹੁੰਚਾ ਸਕਣ ਜੇ ਕੋਈ ਵਪਾਰ ਇਸ ਤਰ੍ਹਾਂ ਦਾ ਹੈ ਕਿ ਜਿਹਦੇ ਵਿੱਚ ਉਹ ਆਪਣੇ ਪ੍ਰੋਡਕਟ ਨੂੰ ਦਿਖਾ ਰਹੇ ਹਨ ਆਪਣੇ ਮੌਜੂਦਾ ਪ੍ਰੋਡਕਟਾਂ ਨੂੰ ਜਾਂ ਫਿਰ ਆਪਣੀਆਂ ਦਿੱਤੀਆਂ ਗਈਆਂ ਸਰਵਿਸਾਂ ਨੂੰ ਦਿਖਾਉਂਦੇ ਪਏ ਹਨ ਇੱਦਾਂ ਦੇ ਇਸ਼ਤਿਹਾਰਾਂ ਨੂੰ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਲੋਕ ਵਪਾਰਕ ਲੋਕ ਜੋ ਹੁੰਦੇ ਹਨ ਉਹ ਇਸ਼ਤਿਹਾਰਾਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਆਪਣੇ ਕੋਲ ਬੁਲਾਉਣ ਦੇ ਲਈ ਜਾਂ ਫਿਰ ਲੋਕਾਂ ਨੂੰ ਕੰਮ 'ਤੇ ਲਿਆਉਣ ਦੇ ਲਈ ਕਹਿੰਦੇ ਹਨ ਜਿਵੇਂ ਕਿ ਲੋਕਾਂ ਨੂੰ ਲੋੜ ਹੈ ਕੰਮ ਦੀ ਅਤੇ ਵਪਾਰਕ ਲੋਕਾਂ ਨੂੰ ਲੋੜ ਹੈ ਕੰਮ ਕਰ ਵਾਲੇ ਦੀ ਜੋ ਕਿ ਉਹਨਾਂ ਦਾ ਕੰਮ ਕਰ ਸਕੇ ਜਿਵੇਂ ਕਿ ਮਜ਼ਦੂਰ ਲੋਕ ਹੁੰਦੇ ਹਨ ਜਾਂ ਫਿਰ ਕੁਝ ਹੋਰ ਵੀ ਵਪਾਰਕ ਲੋਕ ਉਹ ਇਸ਼ਤਿਹਾਰਾਂ ਨੂੰ ਵਰਤ ਕੇ ਆਪਣੇ ਵਪਾਰ ਦੀ ਪ੍ਰਸਿੱਧੀ ਕਰਵਾਉਂਦੇ ਹਨ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਵਧੀਆ ਲੱਗਦੀਆਂ ਹਨ ਪਰ ਇਸ਼ਤਿਹਾਰ ਬਹੁਤ ਘੱਟ ਲੱਗਦੇ ਹਨ ਇਸ਼ਤਿਹਾਰਾਂ 'ਚ ਕੁਛ ਅਜਿਹਾ ਖਾਸ ਹੋਣਾ ਚਾਹੀਦਾ ਹੈ ਜੋ ਕਿ ਲੋਕਾਂ ਨੂੰ ਭਾਉਂਦਾ ਹੈ ਇਸ਼ਤਿਹਾਰ ਕੁਛ ਰਚਨਾਤਮਕ ਹੁੰਦੇ ਹਨ ਅਤੇ ਕੁਛ ਵਧੀਆ ਹੁੰਦੇ ਹਨ ਧੰਨਵਾਦ